ਹੈਲੋ ਤੁਸੀਂ ਕਲੱਬ ਦੇ ਪ੍ਰਧਾਨ ਸਾਹਿਬ ਬੋਲਦੇ ਹੈ ਜੀ ਹਾਂਜੀ ਅਤੇ ਅਸੀਂ ਨਾ ਜੀ ਇਹ ਗੱਲ ਕਰਦੇ ਸੀ ਤੁਹਾਡੇ ਨਾਲ ਵੀ ਹੁਣ ਬੱਚਿਆਂ ਨੂੰ ਛੁੱਟੀਆਂ ਹੋ ਚੁੱਕੀਆਂ ਹੈ ਅਤੇ ਆਪਾਂ ਬੱਚਿਆਂ ਨੂੰ ਕੁਛ ਨਵਾਂ ਸਿਖਾਈਏ ਵੀ ਬੱਚਿਆਂ ਦਾ ਟੈਮ ਪਾਸ ਹੋ ਜਾਵੇ ਕੋਈ ਪੇਂਟਿੰਗ ਕੋਈ ਆਰਟ ਦਾ ਕੰਮ ਕੋਈ ਕਢਾਈ ਦਾ ਕੁੜੀਆਂ ਨੂੰ ਸਿਖਾਈਏ ਅਤੇ ਉਹਦੇ ਬਾਰੇ ਕੁਛ ਤੁਸੀਂ ਕਰੋ ਜੀ ਹੈ ਨਾ ਵੈਸੇ ਤਾਂ ਤੁਸੀਂ ਬਹੁਤ ਸੋਹਣੇ ਕੰਮ ਕਰ ਰਹੇ ਹੋ ਸਾਰੇ ਇਸ ਕਰਕੇ ਹੁਣ ਛੋਟੇ ਬੱਚੇ ਹੈ ਜਾਂ ਥੋੜ੍ਹੇ ਵੱਡੇ ਹੈ ਉਹਨਾਂ ਵਾਸਤੇ ਵੀ ਕੁਛ ਕਰੋ ਕੰਮ ਹਾਂਜੀ ਵੀ ਵਧੀਆ ਪੇਂਟਿੰਗ ਕੋਈ ਨਾਟਕ ਬੱਚਿਆਂ ਨੂੰ ਸਿਖਾਇਆ ਜਾਵੇ ਜਿਸ ਤੋਂ ਜਾਣ ਵੀ ਬਾਹਰ ਨਾਂ ਜਾਣ ਅੰਦਰ ਅੰਦਰ ਕੰਮ ਹੋ ਜਾਵੇ ਅਤੇ ਇਸ ਕਰਕੇ ਵੀ ਇ ਇਹਦਾ ਕੋ ਕੋਈ ਉਪਰਾਲਾ ਕਰੋ

ਹਾਂਜੀ ਹਾਂਜੀ

ਹਾਂਜੀ ਜ਼ਰੂਰ ਇਹ ਕੰਮ ਕਰੋ ਇਹ ਬਹੁਤ ਬੱਚਿਆਂ ਵਾਸਤੇ ਫਿਰ ਬੱਚ ਬੱਚਿਆਂ ਦਾ ਉਤਸ਼ਾਹ ਬਣਦਾ ਹੈ ਨਾਲੇ ਤਾਂ ਨਾਲੇ ਟੈਮ ਪਾਸ ਹੋ ਜਾਂਦਾ ਹੈ ਛੁੱਟੀਆਂ ਹੋਈਆਂ ਵੀਆਂ ਨਹੀਂ ਤਾਂ ਬੱਚੇ ਧੁੱਪ 'ਚ ਬਿਮਾਰ ਹੁੰਦੇ ਹੈਗੇ ਫਿਰ ਹਾਂਜੀ

ਠੀਕ ਹੈ ਜੀ ਇਹਦਾ ਜ਼ਰੂਰ ਕਰਨਾ ਜੀ ਹੱਲ ਹਾਂਜੀ ਠੀਕ ਹੈ ਜੀ ਓਕੇ